ਮੈਂ ਮਾਧੋਪੁਰ ਇਲਾਕੇ ਤੋਂ ਬਿਲੋਂਗ ਕਰਦਾ ਹਾਂ ਇੱਥੇ ਬਹੁਤ ਸਾਰੀ ਨਦੀਆਂ ਝੀਲਾਂ ਹਨ ਮੈਂ ਇੱਕ ਐਸੇ ਇਲਾਕੇ ਤੋਂ ਬਿਲੋਂਗ ਕਰਦਾ ਹਾਂ ਜਿੱਥੇ ਸਾਡਾ ਡੈਮ ਵੀ ਪੈਂਦਾ ਹੈ ਸਾਡੇ ਇੱਥੇ ਬਹੁਤ ਸਾਰੀਆਂ ਨਦੀਆਂ ਝੀਲਾਂ ਆਮ ਹਨ ਇਨ੍ਹਾਂ ਝੀਲਾਂ ਵਿੱਚ ਜਲ ਘਰ ਵੀ ਬਣੇ ਹਨ ਜਿਨ੍ਹਾਂ ਵਿੱਚ ਲੋਕ ਬੋਟਿੰਗ ਫਿਸ਼ਿੰਗ ਵੀ ਅਕਸਰ ਕਰਦੇ ਹਨ ਸਾਡੇ ਇੱਥੇ ਇੱਕ ਜਗ੍ਹਾ ਸਥਿੱਤ ਹੈ ਜਿਹਦਾ ਨਾਮ ਹੈ ਮਿੰਨੀ ਗੋਆ ਇਹ ਕਾਫ਼ੀ ਆਕਰਸ਼ਿਕ ਅਤੇ ਟੂਰਿਜ਼ਮ ਵਾਲੀ ਜਗ੍ਹਾ ਹੈ ਇੱਥੇ ਲੋਕ ਬੋਟਿੰਗ ਕਰਦੇ ਹਨ ਅਤੇ ਫਿਸ਼ਿੰਗ ਬਹੁਤ ਘੱਟ ਕਰਦੇ ਹਨ ਲੇਕਿਨ ਬੋਟਿੰਗ ਦਾ ਇੱਥੇ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਹੈ ਬੋਟਿੰਗ ਇੱਕ ਐਸੀ ਚੀਜ਼ ਹੈ ਜਿਸ ਵਿੱਚ ਲੋਕ ਬੈਠ ਕੇ ਝੀਲ ਵਿੱਚ ਝੀਲ ਦੇ ਨਜ਼ਾਰੇ ਲੈਂਦੇ ਹਨ ਅਤੇ ਇਸ ਦੀ ਸਾਂਭ ਸੰਭਾਲ ਸਾਰੀ ਸਰਕਾਰ ਦੇ ਹਿੱਸੇ ਆਉਂਦੀ ਹੈ ਸਰਕਾਰ ਬਹੁਤ ਕੰਮ ਕਰ ਰਹੀ ਹੈ ਪੰਜਾਬ ਨੂੰ ਅੱਗੇ ਵਧਾਉਣ ਲਈ ਨਦੀਆਂ ਅਤੇ ਝੀਲਾਂ ਵੀ ਇਸਦੇ ਮੁਕਾਬਲੇ ਹੋ ਚੁੱਕੀਆਂ ਹਨ ਫਿਰ ਵੀ ਉਸਦਾ ਕੀ ਕਿ ਸਾਹਮਣੇ ਕੀਤਾ ਹੈ ਉਹ ਹੋਰ ਦੂਰ ਦਰ ਚੱਲਦਾ ਹੈ ਬੈਟਿੰਗ ਬੋਟਿੰਗ ਅਤੇ ਜਲ ਘਰ ਦੀ ਸੰਭਾਲ ਸਾਰਾ ਸਰਕਾਰ ਦੇ ਹੀ ਆਉਂਦਾ ਹੈ